ਪਿੰਡਾਂ ਵਿੱਚ ਪਾਣੀ ਦੇ ਵੱਖ ਵੱਖ ਸਰੋਤ ਹਨ ਸਬਮਰਸੀਬਲ ਨਲਕੇ ਸਰਕਾਰੀ ਟੂਟੀਆਂ ਸਿੰਪਲ ਜੇ ਸਬਮਰਸੀਬਲ ਨਲਕਿਆਂ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਹਰ ਸਮੇਂ ਪਾਣੀ ਉਪਲੱਬਧ ਹਨ ਜੇਕਰ ਸਰਕਾਰੀ ਟੂਟੀਆਂ ਦੀ ਗੱਲ ਕਰੀਏ ਤਾਂ ਸਰਕਾਰੀ ਟੂਟੀਆਂ ਦੇ ਪਾਣੀ ਦੀ ਦਿੱਕਤਾਂ ਬਹੁਤ ਆਉਂਦੀਆਂ ਹਨ